ਜੀ ਹਾਂ ਮੈਨੂੰ ਫੋਟੋਆਂ ਖਿੱਚਣ ਦਾ ਬਹੁਤ ਹੀ ਸ਼ੌਕ ਹੈ ਅਤੇ ਮੈਂ ਅਲੱਗ ਅਲੱਗ ਪੋਜ਼ ਦੇ ਵਿੱਚ ਫੋਟੋਆਂ ਖਿਚਵਾਉਂਦਾ ਹਾਂ ਅਤੇ ਮੇਰੀਆਂ ਫੋਟੋਆਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਮੈਨੂੰ ਫੋਲੋ ਵੀ ਕਰਦੇ ਹਨ ਅਤੇ ਮੇਰੀਆਂ ਫੋਟੋਆਂ ਨੂੰ ਲਾਈਕ ਵੀ ਕਰਦੇ ਹਨ ਅਤੇ ਉਸ ਉਸਦੇ ਪੋਜ਼ ਵਿੱਚ ਫੋਟੋਆਂ ਖਿਚਵਾਉਂਦੇ ਹਨ